ਸ੍ਰੀ ਅੰਮ੍ਰਿਤਸਰ ਸਾਹਿਬ ਸਿੱਖਾਂ ਦਾ ਪ੍ਰਮੁੱਖ ਕੇਂਦਰ ਜਿਹੜਾ ਕਿ ਗੁਰੂ ਰਾਮ ਦਾਸ ਜੀ ਨੇ ਵਿਸ਼ਾਇਆ ਵਸਾਇਆ ਹੋਇਆ ਸ਼ਹਿਰ ਬਹੁਤ ਹੀ ਸੁੰਦਰਤਾ ਦਾ ਪ੍ਰਤੀਕ ਜਿੱਥੋਂ ਪੂਰੇ ਹੀ ਪੰਜਾਬ ਦੀ ਝਲਕ ਦੇਖਣ ਨੂੰ ਮਿਲਦੀ ਹੈ ਉੱਥੋਂ ਦੀ ਖੂਬਸੂਰਤੀ ਵਿੱਚ ਚਾਰ ਚੰਦ ਲਗਾਉਂਦਾ ਹੋਇਆ ਗੋਲਡਨ ਟੈਂਪਲ ਸ਼੍ਰੀ ਹਰਮੰਦਰ ਸਾਹਿਬ ਜਿੱਥੇ ਜਾ ਕੇ ਇੱਕ ਇੱਦਾਂ ਦੀ ਰੂਹ ਦਾ ਅਹਿਸਾਸ ਹੁੰਦਾ ਹੈ ਜਿਹੜਾ ਕਿ ਦਿਲ ਨੂੰ ਬਹੁਤ ਹੀ ਤਕੜਾ ਸਕੂਨ ਦਿੰਦਾ ਹੈ ਇੱਥੇ ਐਸ ਜੀ ਪੀ ਸੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਜੋ ਕਿ ਇਸ ਪੂਰੇ ਕੰਮ ਕਾਰ ਨੂੰ ਸੰਭਾਲਦੀ ਹੈ ਸਭ ਤੋਂ ਵੱਡੀ ਗੱਲ ਉੱਥੋਂ ਦਾ ਜਿਹੜਾ ਦੁੁਨੀਆਂ ਦੀ ਸਭ ਤੋਂ ਵੱਡੀ ਰਸੋਈ ਘਰ ਜੋ ਉੱਥੋਂ ਦਾ ਲੰਗਰ ਹਾਲ ਹੈ ਘੱਟੋ ਘੱਟ ਉੱਥੇ ਇੱਕ ਦਿਨ ਦੇ ਵਿੱਚ ਲੱਖ ਤੋਂ ਸਵਾ ਲੱਖ ਬੰਦਾ ਲੰਗਰ ਛੱਕਦਾ ਹੋਇਆ ਗੁਰੂਦੁਆਰਾ ਸਾਹਿਬ ਦੇ ਉੱਪਰ ਗੁਰੂ ਜੀ ਦੀ ਐਡੀ ਤਕੜੀ ਮਿਹਰ ਹੈ ਕਿ ਜਿਹਨੂੰ ਚਾਰ ਸ਼ਬਦਾਂ ਵਿੱਚ ਬਿਆਨ ਕੀਤਾ ਹੀਂ ਨਹੀਂ ਜਾ ਸਕਦਾ ਅੰਮ੍ਰਿਤਸਰ ਸਾਹਿਬ ਜਿਹੜਾ ਕਿ ਇੱਕ ਪੰਜਾਬ ਦੀ ਕਲਾ ਅਤੇ ਸੰਸਕ੍ਰਿਤੀ ਨੂੰ ਦਿਖਾਉਂਦਾ ਹੈ ਇੱਥੇ ਵੱਖ ਵੱਖ ਦੂਰੋਂ ਦੂਰੋਂ ਹਰ ਅੱਡੋ ਅੱਡੀ ਕੰਟਰੀ ਦੇ ਵਿੱਚੋਂ ਦੀਨ ਦੁਨੀਆ ਦੇਖਣ ਵਾਸਤੇ ਇੱਥੇ ਆਉਂਦੀ ਹੈ ਅਤੇ ਇੱਥੇ ਪੰਜਾਬ ਦਾ ਸੱਭਿਆਚਾਰ ਆਪਣੇ ਅੱਖੀਂ ਦੇਖਦੀ ਹੈ ਉਸ ਤੋਂ ਬਾਅਦ ਇੱਥੇ ਜੋ ਕਿ ਇੱਕ ਬਹੁਤ ਹੀ ਵੱਡੀ ਹਿਸਟਰੀ ਦੀ ਘਟਨਾ ਵਾਪਰੀ ਹੋਈ ਹੈ ਜਲ੍ਹਿਆਂ ਵਾਲਾ ਬਾਗ ਜਿੱਥੇ ਕਿ ਹਜ਼ਾਰਾਂ ਸਿੱਖ ਕੁਰਬਾਨ ਹੋ ਗਏ ਸੀਗੇ ਜਿਨ੍ਹਾਂ 'ਤੇ ਅੰਨੇਵਾਹ ਗੋਲੀਆਂ ਚਲਾਈਆਂ ਗਈਆਂ ਜੋ ਕਿ ਇਤਿਹਾਸ ਦੇ ਬਹੁਤ ਹੀ ਵੱਡੀ ਘਟਨਾ ਗੀ ਜੋ ਕਿ ਰੋਲਡ ਐਕਟ ਦੇ ਵਿਰੁੱਧ ਵਿੱਚ ਇੱਥੇ ਇਕੱਠੇ ਹੋਏ ਸਨ